ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਕੌਰ ਮੈਂ ਨੂਰਪੁਰ ਬੇਦੀ ਦੀ ਰਹਿਣ ਵਾਲੀ ਹਾਂ ਪੱਚੀ ਤਰੀਕ ਨੂੰ ਸਾਡੇ ਘਰ ਰਿਸ਼ਤੇਦਾਰਾਂ ਨੇ ਆਉਣਾ ਹੈ ਮੈਂ ਤੁਹਾਡੇ ਕੋਲੋਂ ਕੁਝ ਆਰਡਰ ਕਰਨਾ ਚਾਹੁੰਦੀ ਹਾਂ ਜਿਸ ਵਿੱਚ ਪੀਜ਼ਾ ਬਰਗਰ ਨਿਊਡਲਸ ਸਪਰਿੰਗ ਰੋਲ ਆਦਿ ਆਦਿ ਆਰਡਰ ਕੀਤਾ ਹੈ ਆਦਿ ਘਰ ਪਹੁੰਚਾਉਣ ਦੀ ਖੇਚਲ ਕਰਨਾ ਤੁਸੀਂ ਮੈਨੂੰ ਟੋਟਲ ਖਰਚਾ ਦੱਸ ਦਿਉ ਅਤੇ ਹੋਮ ਅਤੇ ਮੈਂ ਔਨਲਾਈਨ ਪੇਮੈਂਟ ਕਰ ਦੇਵਾਂਗੀ ਅਤੇ ਨਾਲ ਹੀ ਆਪਣਾ ਸਕੈਨ ਕੋਡ ਦੱਸ ਦਿਉ ਧੰਨਵਾਦ